ਸਾਡਾ ਧਰਮ ਸਾਨੂੰ ਸਮਾਜ ਸੇਵਾ ਬਾਰੇ ਬਹੁਤ ਸਿਖਾਉਂਦਾ ਹੈ ਅਸੀਂ ਦੇਖੀਏ ਤਾਂ ਪੰਜਾਬ ਦੇ ਵਿੱਚ ਸਿੱਖ ਧਰਮ ਜੋ ਹੈ ਇਹ ਬਹੁਤ ਹੀ ਸਮਾਜ ਦੀ ਸੇਵਾ ਕਰਦੇ ਹਨ ਜਗ੍ਹਾ ਜਗ੍ਹਾ 'ਤੇ ਲੰਗਰ ਲਗਾਉਂਦੇ ਹਨ ਕਹਿੰਦੇ ਹਨ ਕਿਤੇ ਵੀ ਕੋਈ ਵੀ ਬਿਪਤਾ ਆ ਜਾਵੇ ਉੱਥੇ ਸਿੱਖ ਆਪਣਾ ਲੰਗਰ ਦਾ ਸਮਾਨ ਲੈ ਕੇ ਪਹੁੰਚ ਜਾਂਦੇ ਹਨ ਅਤੇ ਉੱਥੇ ਇੱਦਾਂ ਨਹੀਂ ਹੁੰਦਾ ਕਿ ਕੋਈ ਲੋਕ ਭੁੱਖੇ ਆ ਜਾਂ ਹੋਰ ਹੈ ਜੇ ਇਹਨਾਂ ਨੇ ਇੱਕ ਵਾਰੀ ਮੋਰਚਾ ਸੰਭਾਲ ਲਿਆ ਤਾਂ ਸੰਭਾਲ ਲਿਆ ਬਸ ਜਿੱਥੇ ਸਿੱਖ ਪਹੁੰਚ ਜਾਂਦੇ ਹੈ ਖਾਣਾ ਲੈ ਕੇ ਲੰਗਰ ਲੈ ਕੇ ਉੱਥੇ ਕਿਸੇ ਨੂੰ ਕੋਈ ਕਮੀ ਨਹੀਂ ਰਹਿੰਦੀ ਜਿਸ ਤਰ੍ਹਾਂ ਕਿ ਇਹਨਾਂ ਨੇ ਦਿੱਲੀ ਵੀ ਮੋਰਚਾ ਲਗਾਇਆ ਤਾਂ ਦਿੱਲੀ ਦੇ ਆਸੇ ਪਾਸੇ ਦੀਆਂ ਜਿੱਥੇ ਮੋਰਚਾ ਲੱਗਿਆ ਸੀ ਉਹਨਾਂ ਦੇ ਆਸੇ ਪਾਸੇ ਦੀਆਂ ਸਾਰੀਆਂ ਕਲੋਨੀਆਂ ਦੇ ਵਿੱਚ ਵੀ ਘਰ ਅਜਿਹੇ ਸਨ ਜਿਹੜੇ ਕਿ ਉਦੋਂ ਭੁੱਖੇ ਨਹੀਂ ਸੌਂਦੇ ਸੀ ਅਤੇ ਇਹ ਜੋ ਲੋਕਾਂ ਨੂੰ ਖਾਣਾ ਪਾਣੀ ਖਿਲਾਉਣ ਵਾਲਾ ਕੰਮ ਹੈ ਇਹ ਸਿੱਖ ਧਰਮ ਦੀ ਬਹੁਤ ਹੀ ਵੱਡੀ ਦੇਣ ਹੈ ਅਤੇ ਇਸ ਕਰਕੇ ਜੋ ਘਰ ਦੇ ਵਿੱਚ ਵੀ ਇਹਨਾਂ ਦੇ ਕੋਈ ਮਹਿਮਾਨ ਆਉਂਦਾ ਉਹਦੀ ਵੀ ਬੜੀ ਹੀ ਚੰਗੇ ਤਰੀਕੇ ਨਾਲ ਇਹਦਾ ਸਵਾਗਤ ਕਰਦੇ ਹਨ ਅਤੇ ਇਸ ਤਰ੍ਹਾਂ ਹੀ ਸਮਾਜ ਸੇਵਾ ਕਰਦੇ ਹਨ